ਹੈਲੋ ਹਾਂਜੀ ਮੈਡਮ ਜੀ ਹੋਸਪਿਟਲ ਤੋਂ ਬੋਲਦੇ ਆ ਜੀ ਅੱਛਾ ਜੀ ਮੈਡਮ ਇੱਕ ਕੰਪਲੇਂਟ ਲਿਖਾਉਣੀ ਸੀ ਤੁਹਾਡੇ ਕੋਲ ਜੀ ਤੁਸੀਂ ਪਹਿਲਾਂ ਕੀ ਨਾ ਸਟਾਫ ਨਰਸ ਕੀ ਹੈਡ ਨਰਸ ਕੋਣ ਆ ਜੀ ਹਾਂਜੀ ਹੈੱਡ ਸਟਾਫ ਓਂ ਜੀ ਤਾਂ ਅੱਛਾ ਠੀਕ ਆ ਮੈਡਮ ਮੈਡਮ ਸਤਿ ਸ਼੍ਰੀ ਅਕਾਲ ਜੀ ਮੈਡਮ ਮੈਂ ਇੱਕ ਨਾ ਕੰਪਲੇਂਟ ਲਖਾਉਣੀ ਸੀ ਤੁਹਾਡੇ ਕੋਲ ਜੀ ਉਹ ਨਾ ਮੇਰੇ ਮਾਤਾ ਇੱਥੇ ਨਾ ਪੇਸੈਂਟ ਦਾਖ਼ਲ ਸੀਗੇ ਜੀ ਅਤੇ ਅਸੀਂ ਉਹ ਬਿੱਲ ਵਗੈਰਾ ਦਿੱਤਾ ਸੀ ਤੁਹਾਨੂੰ ਅਤੇ ਉਹਨਾਂ ਨੇ ਸਾਨੂੰ ਬੈਡ ਚਾਰਜ ਲਗਾਇਆ ਵਾਧੂ ਜੀ ਅਤੇ ਇੱਕ ਮੈਡੀਕਲ ਮੈਮ ਦਵਾਈਆਂ ਦੇ ਵਿੱਚ ਵੀ ਬਹੁਤ ਉਹਨਾਂ ਨੇ ਆਜ਼ਿਦਾ ਲਾਏ ਪੈਸੇ ਜੀ ਹਾਂਜੀ ਅਤੇ ਉਹ ਬਹੁਤ ਦੱਸੋ ਜੀ ਕਿਦਾਂ ਕਰਨੀ ਅ ਜੀ ਅਤੇ ਐਂ ਤਾਂ ਮੈਡਮ ਫਿਰ ਹੀ ਕਿਹਾ ਜੀ ਐਵੇਂ ਤਾਂ ਕੋਈ ਕਹਿੰਦਾ ਹੀ ਨਹੀਂ ਜੀ ਜੇ ਕੋਈ ਗੱਲ ਹੈਗੀ ਤਾਂ ਹੀ ਤੁਹਾਨੂੰ ਦੱਸਿਆ ਜੀ ਹਾਂਜੀ ਚਲੋ ਫਿਰ ਕਿਵੇਂ ਉਹਦਾ ਮੈਡਮ ਕਿਵੇਂ ਕਰੋਗੇ ਜੀ ਬਿੱਲਾਂ ਦਾ ਜੀ

ਵੱਡਾ ਮਨ ਸਾਡੇ ਵਾਸਤੇ ਤਾਂ ਬਹੁਤ ਵੱਡਾ ਜੀ ਮਾਤਾ ਜੀ ਨੇ ਕਿਵੇਂ ਪੈਸੇ ਇਕੱਠੇ ਕਰਕੇ ਦਿੱਤੇ ਕਿਵੇਂ ਨਹੀਂ ਦਿੱਤੇ ਜੀ ਐਂ ਨਾ ਮੈਡਮ ਆਪਣਾ ਸਾਰਾ ਹਿਸਾਬ ਕਿਤਾਬ ਵੇਖਦਾ ਬੰਦਾ ਉਸ ਹਿਸਾਬ ਨਾਲ ਚੱਲਦਾ ਹੁਣ ਇਹ ਚੈੱਕ ਕਰਵਾਇਆ ਕਿਸੇ ਤੋਂ ਉਹ ਕਹਿੰਦਾ ਮੈਡੀਕਲ ਤੁਹਾਡੇ ਬਹੁਤ ਜ਼ਿਆਦਾ ਪੈਸੇ ਲਾਏ ਆ ਇੱਕ ਚਾਰਜ ਵੀ ਤੁਹਾਡੇ ਬੈਡ ਚਾਰਜ ਵੀ ਵੱਧ ਲਿਆ

ਤੁਹਾਡਾ ਨਾਮ ਕੀ ਆ ਮੈਡਮ ਜੀ ਮਨਪ੍ਰੀਤ ਮੁਕਤਸਰ ਦੇ ਆ ਜੀ ਅੱਛਾ ਜੀ ਤਾਂ ਮੈਡਮ ਕਿੱਥੇ ਮਿਲ ਸਕਦੇ ਤੁਸੀਂ ਕਦੋਂ ਮਿਲੂਗੇ ਜੀ ਅੱਛਾ ਜੀ ਅੱਛਾ ਜੀ

ਠੀਕ ਕਦੋਂ ਆਈਏ ਮੈਡਮ ਜੀ ਤੁਹਾਡੇ ਕੋਲ ਫਿਰ ਸੰਡੇ ਆ ਜਾਈਏ ਭਮਾ ਜੀ ਚਲੋ ਅਤੇ ਮੈਡਮ ਬਿਲ ਬੁਲ ਲੈ ਕੇ ਆਉਣੇ ਪੈਣਗੇ ਸਾਰੇ ਉਹ ਨਾਲ ਜੀ ਅੱਛਾ ਜੀ ਚਲੋ ਠੀਕ ਆ ਫਿਰ ਡਾਕਟਰ ਸਾਹਿਬ ਨੂੰ ਮਿਲ ਕੇ ਸਾਡਾ ਕਰਵਾ ਦਿਓ ਸ਼ੁਕਰੀਆ ਜੀ ਚਲੋ ਠੀਕ ਆ ਮੈਡਮ ਜੀ